ਡੋਰਮੈਟ ਅਸੀਂ ਘਰ ਦੇ ਅੱਗੇ ਇਸ ਲਈ ਰੱਖਦੇ ਹਾਂ ਕਿ ਸਾਨੂੰ ਨਾ ਜੁੱਤੇ ਸਾਡੇ ਸਾਫ਼ ਰਹਿਣ ਜਿਹੜਾ ਬਾਹਰੋਂ ਗੰਦ ਲੱਗ ਜਾਂਦਾ ਮਿੱਟੀ ਘੱਟਾ ਹੋਰ ਗੰਦ ਅਤੇ ਉਹ ਫੇਰ ਜੁੱਤੇ ਸਾਫ ਹੋ ਜਾਂਦੇ ਹੈ ਜੁੱਤੇ ਮੈਟ ਦੇ ਕੋਲ ਖੋਲ ਕੇ ਆਪਾਂ ਪੈਰ ਸਾਫ਼ ਕਰਕੇ ਅੰਦਰ ਚਲੇ ਜਾਂਦੇ ਹਾਂ ਅਤੇ ਬਾਹਰ ਕਈ ਵਾਰੀ ਅਸੀਂ ਪੂਜਾ ਰੂਮ ਵੀ ਬਾਹਰ ਹੀ ਐਂਟਰੈਂਸ 'ਤੇ ਹੀ ਹੁੰਦਾ ਸਾਡਾ ਅੰਦਰ ਜਾਣ ਅਤੇ ਦਰਵਾਜੇ ਦੇ ਵਿੱਚ ਹੀ ਅਤੇ ਉਸ ਲਈ ਵੀ ਠੀਕ ਰਹਿੰਦਾ ਹੈ ਅਤੇ ਘਰ 'ਚ ਮਿੱਟੀ ਘੱਟਾ ਵੀ ਘੱਟ ਜਾਂਦਾ ਸਾਫ਼ ਸਫ਼ਾਈ ਨੂੰ ਘੱਟ ਟਾਈਮ ਲੱਗਦਾ ਫਿਰ ਨਹੀਂ ਤਾਂ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਵੀ ਬੱਚਦੇ ਹਾਂ ਬਾਹਰੋਂ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਸਾਡੇ ਪੈਰ ਲੱਗੇ ਹੁੰਦੇ ਹੈ ਅਤੇ ਜੁੱਤਿਆਂ ਨੂੰ ਗੰਦ ਲੱਗਿਆ ਹੁੰਦਾ ਹੈ ਉਹ ਜੁੱਤੇ ਅਸੀਂ ਬਾਹਰ ਖੋਲਦੇ ਹਾਂ ਤਾਂ ਅਸੀਂ ਸਿਹਤ ਵੀ ਸਾਡੀ ਠੀਕ ਰਹਿੰਦੀ ਹੈ ਇਸ ਲਈ ਸਾਨੂੰ ਜੁੱਤੇ ਬਾਹਰ ਡੋਰਮੈਟ ਬਹੁਤ ਜਰੂਰੀ ਹੈ ਦਰਵਾਜ਼ੇ ਦੇ ਉੱਤੇ ਰੱਖੇ ਹੋਏ